ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਇਸ ਪ੍ਰਕਾਰ ਹਨ ਜਿਹੜਾ ਕਿ ਸਭ ਤੋਂ ਪਹਿਲੇ ਆਉਂਦਾ ਹੈ ਦਿਵਾਲੀ ਦਿਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦਰਬਾਰ ਸਾਹਿਬ ਦੀ ਦਿਵਾਲੀ ਬਹੁਤ ਮਸ਼ਹੂਰ ਹੈ ਬਹੁਤ ਧੂਮਧਾਮ ਨਾਲ ਪਟਾਕੇ ਚਲਾਏ ਜਾਂਦੇ ਹਨ ਅਤੇ ਸਾਰੇ ਸ਼ਹਿਰ 'ਚ ਲੋਕ ਬੜੇ ਖੁਸ਼ੀਆਂ ਨਾਲ ਇਹ ਤਿਉਹਾਰ ਮਨਾਉਂਦੇ ਹਨ ਉਸ ਤੋਂ ਬਾਅਦ ਇੱਥੇ ਇੱਕ ਲੋਹੜੀ ਦਾ ਤਿਉਹਾਰ ਬੜਾ ਮਸ਼ਹੂਰ ਹੈ ਜਿਸ 'ਚ ਬੱਚੇ ਬੜੇ ਖੁਸ਼ ਹੋ ਕੇ ਦ ਪਤੰਗਾਂ ਉਡਾਉਂਦੇ ਹਨ ਰਾਤ ਵੇਲੇ ਲੋਹੜੀ ਬਾਲ ਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਠੰਡ ਵਿੱਚ ਅੱਗ ਬਾਲ ਕੇ ਲੋਹੜੀ ਮਨਾਉਂਦੇ ਹਨ ਲੋਕ ਉਸ ਤੋਂ ਬਾਅਦ ਇੱਥੇ ਹੋਲੀ ਦਾ ਤਿਉਹਾਰ ਬੜਾ ਮਸ਼ਹੂਰ ਹੈ ਹੋਲੀ ਦੇ ਤਿਉਹਾਰ ਦੇ ਵਿੱਚ ਲੋਕ ਇੱਕ ਦੂਜੇ 'ਤੇ ਰੰਗ ਸੁੱਟ ਕੇ ਹੋਰ ਅਤੇ ਪਾਣੀ ਦੇ ਗੁਬਾਰੇ ਮਾਰ ਕੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ ਹੋਰ ਬਾਕੀ ਦਸ ਗੁਰੂ ਆਪਣੇ ਜਿਹੜੇ ਗੁਰੂ ਸਾਹਿਬ ਹਨ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਹਨ ਲੰਗਰ ਲਗਾਏ ਜਾਂਦੇ ਹਨ ਇਸ ਤੋਂ ਬਾਅਦ ਅਤੇ ਨਾਲ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਸਾਰੇ ਤਿਉਹਾਰ